ਸਾਡੇ ਖੇਤਰ ਵਿੱਚ ਦਰਿਆ ਹੈ ਜਿਸਦੇ ਨਾਲ਼ ਹੀ ਕਿੱਕਰ ਵਾਟਰ ਫਰੰਟ ਹੈ ਜਿੱਥੇ ਘੁੰਮਣ ਵਿੱਚ ਕਾਫੀ ਮਜ਼ਾ ਆਉਂਦਾ ਹੈ ਅਤੇ ਅਸੀਂ ਘੁੰਮ ਕੇ ਉੱਥੇ ਖਾ ਪੀ ਕੇ ਵਾਪਿਸ ਘਰ ਆ ਜਾਂਦੇ ਹਨ